ਹਾਂਜੀ ਅਮਨ ਓਲਾ ਡਰਾਈਵਰ ਸਰ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਪਟਿਆਲਾ ਟੂ ਚੰਡੀਗੜ੍ਹ ਲਈ ਸਰ ਜਿਹਦੀ ਟਾਈਮਿੰਗ ਸੀਗੀ ਤਿੰਨ ਵਜੇ ਸਰ ਮੈਂ ਤੁਹਾਨੂੰ ਤਿੰਨ ਪੰਜ ਤਿੰਨ ਦਸ ਤਿੰਨ ਪੰਦਰਾਂ ਤਿੰਨ ਪੰਦਰਾਂ ਤੱਕ ਜਿਹੜੀ ਮੈਂ ਤੁਹਾਨੂੰ ਕੋਲ ਟਰਾਈ ਕੀਤੀ ਹੈ ਇੱਕ ਵਾਰ ਤੁਸੀਂ ਕੋਲ ਪਿਕ ਕਰਕੇ ਕਿਹਾ ਵੀ ਮੈਂ ਔਨ ਟਾਈਮ ਹਾਂ ਸਰ ਤੁਹਾਡੀ ਲੋਕੇਸ਼ਨ ਵੀ ਜਿਹੜੀ ਮੈਨੂੰ ਨੀਅਰ ਦਿਖਾ ਰਹੀ ਸੀ ਪਰ ਥੋੜ੍ਹੇ ਟਾਈਮ ਬਾਅਦ ਉਹ ਕਾਫੀ ਡਿਸਟੈਂਸ 'ਤੇ ਚਲੇ ਜਾਂਦੀ ਸੀ ਸਰ ਮੇਰਾ ਜਿਹੜਾ ਮੈਂ ਮਤਲਬ ਕਿ ਇੱਥੋਂ ਨਿਕਲ ਚੁੱਕੀ ਹਾਂ ਕਿਸੇ ਰਿਲੇਟਿਵਸ ਦੇ ਨਾਲ ਮੈਂ ਚਲੀ ਗਈ ਹਾਂ ਸਰ ਮੇਰਾ ਜਿਹੜਾ ਇਗਜ਼ਾਮ ਸੀ ਇਗਜ਼ਾਮ ਲਈ ਮੈਂ ਬਿਲਕੁਲ ਵੀ ਜਿਹੜਾ ਲੇਟ ਨਹੀਂ ਹੋ ਸਕਦੀ ਸੀ ਇਗਜ਼ਾਮ ਦੇ ਵਿੱਚ ਉਹ ਅਲਾਓ ਨਹੀਂ ਕਰਦੇ ਸਾਨੂੰ ਲੇਟ ਪਹੁੰਚਣਾ ਸਰ ਮੈਂ ਤੁਹਾਨੂੰ ਇਹੀ ਕਹਿਣਾ ਵੀ ਜਿਹੜੀ ਮੈਂ ਇਹ ਕੈਬ ਹੈ ਮੈਂ ਕੈਂਸਲ ਕਰਨੀ ਆ ਕਿਉਂਕਿ ਸਰ ਮੈਨੂੰ ਕਾਫੀ ਮਤਲਬ ਕਿ ਟਰਾਈ ਦੇ ਬਾਵਜੂਦ ਵੀ ਜਿਹੜਾ ਤੁਸੀਂ ਮੇਰੇ ਕੋਲ ਸਹੀ ਟਾਈਮ 'ਤੇ ਨਹੀਂ ਪਹੁੰਚੇ ਸੋ ਹੁਣ ਇਹ ਜਿਹੜੀ ਕੈਬ ਆ ਤੁਸੀਂ ਆਪਣੀ ਜਿਹੜੀ ਕੈਂਸਲ ਕਰ ਦੇਵੋ ਕਿਉਂਕਿ ਮੈਂ ਜਿਹੜਾ ਆਪਣਾ ਸਟੇਸ਼ਨ ਹੈ ਉਹਨੂੰ ਛੱਡ ਚੁੱਕੀ ਹਾਂ ਮੈਂ ਮੈਨੂੰ ਪੰਦਰਾਂ ਵੀਹ ਮਿੰਟ ਵੇਟ ਕਰਨ ਦੇ ਬਾਵਜੂਦ ਵੀ ਜਿਹੜੀ ਤੁਸੀਂ ਮੈਨੂੰ ਕੋਈ ਰਿਸਪੋਂਸ ਨਹੀਂ ਦਿੱਤਾ ਤਾਂ ਮੈਂ ਇੱਥੋਂ ਸਰ ਨਿਕਲ ਚੁੱਕੀ ਹਾਂ